ਮੇਰੀ ਜਿਹੜੀ ਮਨਪਸੰਦ ਗੇਮ ਆ ਉਹ ਵਾਲੀਵਾਲ ਆ ਵਾਲੀਬਾਲ ਕਿਉਂ ਆ ਇਹਦਾ ਇੱਕ ਬਹੁਤ ਵੱਡਾ ਕਾਰਨ ਆ ਵੀ ਕਿਉਂਕਿ ਜਿਹੜੀ ਤੁਹਾਡੀ ਅੰਦਰ ਦੀ ਰੁਚੀ ਆ ਕੰਮ ਕਰਨ ਦੀ ਕੋਈ ਵੀ ਕੰਮ ਕਰਨਾ ਅੰਦਰ ਤੁਹਾਡੇ ਰੁ ਰੁਚੀ ਹੋਣੀ ਚਾਹੀਦੀ ਆ ਸੋ ਬਚਪਨ ਦੇ ਵਿੱਚ ਜੇ ਤੁਹਾਡੀ ਰੁਚੀ ਬਚਪਨ ਤੋਂ ਹੀ ਬਣ ਜਾਵੇ ਤਾਂ ਇਹ ਬਹੁਤ ਵਧੀਆ ਸਾਬਤ ਹੁੰਦੀ ਆ ਸੋ ਬਚਪਨ ਦੇ ਵਿੱਚ ਸਾਡੇ ਘਰ ਤੋਂ ਥੋੜ੍ਹਾ ਜਿਹਾ ਦੂਰ ਗਰਾਊਂਡ ਸੀ ਉੱਥੇ ਨੈਟ ਲੱਗਿਆ ਹੋਇਆ ਸੀ ਵਾਲੀਬਾਲ ਦਾ ਤੋ ਸਾਰੇ ਪਿੰਡ ਦੇ ਜਿਹੜੇ ਆ ਨੌਜਵਾਨ ਉੱਥੇ ਖੇਡਦੇ ਸੀ ਵਾਲੀਬਾਲ ਬਹੁਤ ਵਧੀਆ ਮੈਚ ਲੱਗਦੇ ਹੁੰਦੇ ਸੀ ਅਤੇ ਅਸੀਂ ਜਿੱਦਾਂ ਚਲੇ ਜਾਣਾ ਦੇਖਣਾ ਮੈਚ ਨਿੱਕੇ ਨਿੱਕੇ ਹੁੰਦੇ ਸੀਗੇ ਸੋ ਜਦੋਂ ਉਹਨਾਂ ਨੇ ਖੇਡਣਾ ਮੈਚ ਤਾਂ ਅਸੀਂ ਵੀ ਵਿੱਚ ਕਈ ਵਾਰੀ ਖੜ੍ਹ ਜਾਣਾ ਖੇਡਣ ਲੱਗ ਪੈਣਾ ਪਰ ਸਾਨੂੰ ਜ਼ਿਆਦਾ ਮੌਕਾ ਨਹੀਂ ਮਿਲਦਾ ਕਿਉਂਕਿ ਅਸੀਂ ਛੋਟੇ ਸੀਗੇ ਉਹ ਸਾਡੇ ਤੋਂ ਵੱਡੇ ਸੀਗੇ ਸੋ ਦੇਖ ਕੇ ਬਹੁਤ ਵਧੀਆ ਲੱਗਣਾ ਜਦੋਂ ਆਪਾਂ ਗੇਮ ਦੇਖਦੇ ਹਾਂ ਖੇਡਦੇ ਇੱਕ ਦਿਨ ਦੋ ਦਿਨ ਦਸ ਦਿਨ ਪੰਦਰ੍ਹਾਂ ਦਿਨ ਵੀਹ ਦਿਨ ਦੇਖਦੇ ਹਾਂ ਤਾਂ ਆਪਣੀ ਰੁਚੀ ਜਿਹੜੀ ਆਟੋਮੈਟਿਕ ਬਣ ਜਾਂਦੀ ਕਿਉਂਕਿ ਰੋਜ਼ ਆਪਾਂ ਦੇਖਦੇ ਫਿਰ ਆਪਣਾ ਅੰਦਰੋਂ ਮਨ ਕਰਦਾ ਕਿ ਹਾਂ ਵੀ ਮੈਂ ਵੀ ਖੇਡਾਂ ਇੱਦਾਂ ਸੋ ਬੰਦਾ ਦੇਖ ਦੇਖ ਕੇ ਜਦੋਂ ਫਿਰ ਹੌਲੀ ਹੌਲੀ ਜਦੋਂ ਵੱਡੇ ਹੁੰਦੇ ਗਏ ਫਿਰ ਹੌਲੀ ਹੌਲੀ ਇੱਕ ਦਿਨ ਇਹੋ ਜਿਹਾ ਆਇਆ ਵੀ ਗਰਾਊਂਡ ਦੇ ਵਿੱਚ ਵੀ ਦਾਖਲ ਹੋ ਗਏ ਖਿਡਾ ਲਿਆ ਉਹਨਾਂ ਨੇ ਪਰ ਗਰਾਊਂਡ ਦੇ ਵਿੱਚ ਉਹ ਇੱਦਾਂ ਜਿਹੜੇ ਸਾਡੇ ਤੋਂ ਵੱਡੇ ਸੀਗੇ ਉਹਨਾਂ ਨੇ ਪਿੱਛੇ ਜਿਹੇ ਲਾਈ ਰੱਖਣਾ ਪਿੱਛੇ ਖੜ੍ਹ ਜਾਉ ਜਿੱਦਾਂ ਉੱਤੇ ਸਾਡੇ ਕੋਈ ਵੀ ਬਾਲ ਆਉਣਾ ਚੱਕਣ ਦਾ ਮੌਕਾ ਕਿਤੇ ਕਿਤੇ ਮਿਲਦਾ ਸੀਗਾ ਜਦੋਂ ਕਿਤੇ ਆ ਜਾਣਾ ਤਾਂ ਕੋਸ਼ਿਸ਼ ਹੁੰਦੀ ਸੀ ਕਿ ਸਹੀ ਚੱਕੀਏ ਕਿਉਂਕਿ ਜੇ ਗਲਤ ਚੱਕ ਲਿਆ ਤਾਂ ਉਹਨੂੰ ਕਹਿੰਦੇ ਹੁੰਦੇ ਬਾਹਰ ਬਹਿ ਜਾ ਵੀ ਤੈਨੂੰ ਖਿਡਾਉਣਾ ਨਹੀਂ ਅਸੀਂ ਸੋ ਅਸੀਂ ਇੱਦਾਂ ਹੀ ਹੌਲੀ ਹੌਲੀ ਹੌਲੀ ਹੌਲੀ ਜਦੋਂ ਵੀ ਮੌਕਾ ਮਿਲਣਾ ਪ੍ਰੈਕਟਿਸ ਕਰਨੀ ਵਾਲੀਵਾਲ ਨਾਲ ਵੀ ਅਸੀਂ ਜਦੋਂ ਕਿਤੇ ਟੀਮ ਦੇ ਵਿੱਚ ਮੌਕਾ ਮਿਲੇ ਤਾਂ ਵਧੀਆ ਖੇਡ ਕੇ ਦਿਖਾਈਏ ਸਾਨੂੰ ਅਗਾਂਹ ਤੋਂ ਵੀ ਮੌਕਾ ਮਿਲੇ ਸੋ ਵੱਡੇ ਹੁੰਦੇ ਗਏ ਹੌਲੀ ਹੌਲੀ ਇੱਦਾਂ ਹੀ ਮੌਕਾ ਵੀ ਮਿਲਦਾ ਗਿਆ ਸੋ ਵਧੀਆ ਖੇਡਣ ਵੀ ਲੱਗ ਪਏ ਸੋ ਇਹ ਬਚਪਨ ਤੋਂ ਹੀ ਰੁਚੀ ਬਣ ਗਈ ਇਹਦੇ ਪ੍ਰਤੀ ਸੋ ਤਕਰੀਬਨ ਜਿੱਥੇ ਵੀ ਸਕੂਲ ਦੇ ਵਿੱਚ ਕੋਲਜ ਦੇ ਵਿੱਚ ਵੀ ਪੜ੍ਹੇ ਉੱਥੇ ਵੀ ਨੈੱਟ ਤਾਂ ਮਿਲ ਹੀ ਜਾਂਦਾ ਜਿੱਥੇ ਨੈਟ ਮਿਲ ਜਾਵੇ ਅੱਜ ਵੀ ਸੋ ਵਾਲੀਬਾਲ ਜਿਹੜਾ ਖੇਡਣ ਦਾ ਮਨ ਕਰ ਆਉਂਦਾ ਆ ਸੋ ਸਭ ਤੋਂ ਜਿਹੜੀ ਮਨਪਸੰਦ ਗੇਮ ਹੈ ਉਹ ਵਾਲੀਬਾਲ ਹੀ ਹੈ